ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲ਼ੀ ਗਿਆਰ੍ਹਾਂ ਜੂਨ ਉੱਨੀ ਸੌ ਚੁਰੰਜਾ ਤੇਈ ਸਤੰਬਰ ਦੋ ਹਜ਼ਾਰ ਇੱਕੀ ਇੱਕ ਜੂਨ ਦੋ ਹਜ਼ਾਰ ਇੱਕ ਗਿਆਰ੍ਹਾਂ ਸਤੰਬਰ ਦੋ ਹਜ਼ਾਰ ਚੌਦ੍ਹਾਂ